ਪਸੂਆਂ ਦੇ ਨਾਲ ਜਿਹੜੀ ਮੇਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੂਟੀਨ ਹ ਉਹ ਇਦਾਂ ਵੀ ਜਿੱਦਾਂ ਹੁਣ ਗਰਮੀਆਂ ਦੇ ਵਿੱਚ ਸਭ ਤੋਂ ਪਹਿਲਾਂ ਪਸ਼ੂ ਜਿਹੜੇ ਰਾਤ ਨੂੰ ਬਾਹਰ ਬੰਨੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਖੁਰਲੀਆਂ ਦੇ ਵਿੱਚ ਕੋਲ ਲਿਆ ਕੇ ਬੰਨਿਆ ਜਾਂਦਾ ਜਿੱਥੇ ਉਹਨਾਂ ਨੂੰ ਅਸੀਂ ਚਾਰਾ ਹਰਾ ਚਾਰਾ ਤੇ ਤੂੜੀ ਦਾ ਮਿਸ਼ਰਣ ਜਿਹੜਾ ਉਹ ਦਿੰਦੇ ਆ ਤੇ ਉਸ ਤੋਂ ਬਾਅਦ ਆਪਾਂ ਉਹਦੇ ਜਿਹੜਾ ਧਾਰਾ ਚੋਣ ਦਾ ਕੰਮ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਪਸ਼ੂਆਂ ਦੀਆਂ ਧਾਰਾਂ ਚੋਈਆਂ ਜਾਂਦੀਆਂ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਪਸ਼ੂਆਂ ਨੂੰ ਜੇਕਰ ਨਹੋ ਨਵੋਣ ਦੀ ਲੋੜ ਹੈ ਤਾਂ ਨਵਾਇਆ ਜਾਂਦਾ ਤੇ ਨਾਲ ਉਹਨਾਂ ਨੂੰ ਪਾਣੀ ਪਿਆਇਆ ਜਾਦਾ ਪਿਆ ਦਿੱਤਾ ਜਾਂਦਾ ਜਾਂ ਜੇ ਨਿਵਾਉਣ ਦੀ ਨਹੀਂ ਲੋੜ ਤਾਂ ਇਕੱਲਾ ਪਾਣੀ ਪਿਆ ਦਿੱਤਾ ਜਾਂਦਾ ਠੀਕ ਹ ਉਹ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਦਿਨ ਦਾ ਇਹ ਜਿਹੜਾ ਸਵੇਰ ਦਾ ਰੋਟੀਨ ਖਤਮ ਹੋ ਜਾਂਦਾ ਫੇਰ ਦੁਪਹਿਰ ਇੱਕ ਵਾਰ ਪਸ਼ੂ ਨੂੰ ਪਾਣੀ ਪਿਲਾ ਕੇ ਦੁਬਾਰਾ ਉਹਨਾਂ ਨੂੰ ਹਰਾ ਚਾਰਾ ਤੇ ਜਿਹੜਾ ਤੂੜੀ ਉਹਦੇ ਨਾਲ ਕੋਈ ਫੀਡ ਜਾਂ ਦਾਣਾ ਜਿਹੜਾ ਆਪਾਂ ਅਲੱਗ ਅਲੱਗ ਅਨਾਜਾਂ ਦਾ ਦਾਣਾ ਬਣਾਇਆ ਜਾਂਦਾ ਪੀਸ ਕੇ ਉਹਨਾਂ ਨੂੰ ਉਹ ਦਿੰਨੇ ਆ ਤੇ ਫਿਰ ਸ਼ਾਮ ਦੇ ਜਾਂ ਧਾਰਾਂ ਦਾ ਟਾਈਮ ਹੋ ਜਾਂਦਾ ਤਾਂ ਇਹਦੇ ਵਿੱਚ ਸ਼ਾਮ ਨੂੰ ਇੱਕ ਇੱਕ ਕਰਕੇ ਪਸ਼ੂ ਦੀਆਂ ਧਾਰਾਂ ਜਿਹੜੀਆਂ ਕੱਢ ਲਈਆਂ ਜਾਂਦੀਆਂ ਧਾਰਾਂ ਕੱਢਣ ਤੋਂ ਬਾਅਦ ਫਿਰ ਰਾਤ ਨੂੰ ਫਿਰ ਪਸ਼ੂਆਂ ਨੂੰ ਜਿਹੜਾ ਹੈਗਾ ਵੀ ਆਪਣੀ ਜਿਹੜੀ ਜਗ੍ਹਾ ਨਿਸ਼ਚਿਤ ਹੈ ਬਾਹਰ ਜਿੱਥੇ ਉਹਨਾਂ ਨੂੰ ਗਰਮੀ ਦਾ ਮੌਸਮ ਦੇ ਵਿੱਚ ਜਿਆਦਾ ਗਰਮੀ ਨਾ ਲੱਗੇ ਤੇ ਜਾ ਮੱਛਰ ਵਗੈਰਾ ਤੋ ਮਤਲਬ ਕੋਈ ਪ੍ਰੋਬਲਮ ਨਾ ਹੋਏ